ਮੈਂ ਆਪਣੀ ਭਾਬੀ ਦੇ ਕਹਿਣ 'ਤੇ ਪਹਿਲੀ ਵਾਰ ਇੰਸਟੈਂਟ ਗੀਜ਼ਰ ਲਗਵਾਇਆ ਸੀ ਗੀਜ਼ਰ ਦੀ ਵਰਤੋਂ ਕਰਕੇ ਇਸਦਾ ਅਨੁਭਵ ਬਹੁਤ ਵਧੀਆ ਰਿਹਾ ਕਿਉਂਕਿ ਇਸ ਵਿੱਚ ਛੇਤੀ ਪਾਣੀ ਗਰਮ ਹੋ ਜਾਂਦਾ ਹੈ ਅਤੇ ਬਿਜਲੀ ਦੀ ਖਪਤ ਵੀ ਬਹੁਤ ਘੱਟ ਹੈ ਇਸਦੀ ਬਣਤਰ ਬਹੁਤ ਹੀ ਵਧੀਆ ਹੈ ਅਤੇ ਇਸਨੇ ਜਗ੍ਹਾ ਵੀ ਬਹੁਤ ਘੱਟ ਲਈ ਹੋਈ ਹੈ ਇਸਦੇ ਵਿੱਚ ਜੋ ਰੋਡਾਂ ਲੱਗੀਆਂ ਹੋਈਆਂ ਹਨ ਉਹ ਰੋਡਾਂ ਵਧੀਆ ਕੁਆਲਿਟੀਆਂ ਦੀਆਂ ਹਨ ਅਤੇ ਬ ਹੱਲੀ ਬਨਤਰ ਪਲਾਸਟਿਕ ਦੀ ਹੋਣ ਕਾਰਨ ਕਰੰਟ ਲੱਗਣ ਤੋਂ ਵੀ ਬਚਾ ਹੈ ਇਹ ਸਸਤਾ ਵੀ ਹੈ ਅਤੇ ਵਧੀਆ ਵੀ ਹੈ